ਬਚਪਨ ਦੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਹਨ ਜਿਵੇਂ ਕਿ ਮੈਂ ਆਪਣੇ ਮਾਸੀ ਦੇ ਬੱਚਿਆਂ ਨਾਲ ਅਸੀਂ ਗੁੱਡੀਆਂ ਪਟੋਲੇ ਖੇਡਦੇ ਸਨ ਗੁੱਡੀਆਂ ਦੇ ਕੱਪੜੇ ਬਣਾਉਂਦੇ ਸਨ ਘਰ ਘਰ ਖੇਡਦੇ ਸਨ ਅਤੇ ਬਹੁਤ ਹੀ ਮੌਜ ਮਸਤੀਆਂ ਕਰਦੇ ਸਨ ਉਹ ਦਿਨ ਬਹੁਤ ਹੀ ਵਧੀਆ ਸਨ